ਮੇਰੇ ਘਰ ਦੀ ਰਸੋਈ ਵਿੱਚ ਤਰ੍ਹਾਂ ਤਰ੍ਹਾਂ ਦੇ ਬਰਤਨਾਂ ਦੀਆਂ ਕਿਸਮਾਂ ਉਪਲਬਧ ਹਨ ਜਿਵੇਂ ਕਿ ਲੋਹੇ ਦੇ ਬਰਤਨ ਸਟੀਲ ਦੇ ਭਾਂਡੇ ਪਿੱਤਲ ਦੇ ਬਰਤਨ ਕੱਚ ਦੇ ਭਾਂਡੇ ਆਦਿ ਪੁਰਾਣੇ ਸਮਿਆਂ ਵਿੱਚ ਪਿੱਤਲ ਦੇ ਭਾਂਡੇ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਸੀ ਅਜੋਕੇ ਸਮੇਂ ਵਿੱਚ ਇਹਨਾਂ ਦੀ ਵਰਤੋਂ ਕਾਫੀ ਘੱਟ ਗਈ ਹੈ ਮੇਰੇ ਘਰ ਦੀ ਰਸੋਈ ਵਿੱਚ ਪਲੇਟਾਂ ਕੋਲੀਆਂ ਚਮਚੇ ਗਲਾਸ ਕੜਛੀ ਕੜਾਹੀ ਕੁਕਰ ਪਤੀਲੇ ਥਾਲ ਡੋਂਘੇ ਆਦਿ ਸ਼ਾਮਿਲ ਹਨ ਜੇਕਰ ਅਸੀਂ ਜਲਦੀ ਸਬਜ਼ੀ ਬਣਾਉਣੀ ਹੁੰਦੀ ਹੈ ਤਾਂ ਅਸੀਂ ਕੂਕਰ ਦੀ ਵਰਤੋਂ ਕਰਦੇ ਹਾਂ ਖੁੱਲੀ ਸਬਜ਼ੀ ਬਣਾਉਣ ਲਈ ਅਸੀਂ ਪਤੀਲੇ ਦੀ ਵਰਤੋਂ ਕਰਦੇ ਹਾਂ ਜਿਸ ਦਾ ਸਵਾਦ ਕੂਕਰ ਦੁਆਰਾ ਬਣਾਈ ਗਈ ਸਬਜ਼ੀ ਤੋਂ ਵੀ ਵੱਧ ਹੁੰਦਾ ਹੈ ਸੁੱਕੀ ਸਬਜ਼ੀ ਬਣਾਉਣ ਲਈ ਅਸੀਂ ਕੜਾਹੀ ਦੀ ਵਰਤੋਂ ਕਰਦੇ ਹਾਂ ਚੌਲ ਬਣਾਉਣ ਲਈ ਵੀ ਅਸੀਂ ਕੁੱਕਰ ਪਤੀਲੇ ਜਾਂ ਕੜਾਹੀ ਦੀ ਵਰਤੋਂ ਕਰਦੇ ਹਾਂ ਅਸੀਂ ਚਾਹ ਨੂੰ ਪਤੀਲੇ ਵਿੱਚ ਬਣਾਉਂਦੇ ਹਾਂ